ਸਿਹਤ ਸੰਭਾਲ ਦੇ ਵਿੱਚ ਰੋਪੜ 'ਚ ਸਰਕਾਰੀ ਹੋਸਪੀਟਲ ਪਹਿਲੇ ਨੰਬਰ 'ਤੇ ਹੈ ਕਾਫੀ ਵਧੀਆ ਫੈਸਿਲਟੀਜ਼ ਹੈਗੀਆਂ ਉੱਥੇ ਅਤੇ ਸਾਨੂੰ ਦਵਾਈਆਂ ਵੀ ਅੰਦਰ ਕਾਫ਼ੀ ਸਾਰੀਆਂ ਫ੍ਰੀ ਵੀ ਮਿਲਦੀਆਂ ਹੈ ਬਹੁਤ ਘੱਟ ਰੇਟ 'ਤੇ ਵੀ ਮਿਲਦੀਆਂ ਹੈ ਕੁਛ ਇਸ ਤਰ੍ਹਾਂ ਵੀ ਹੈਗਾ ਅਤੇ ਸ਼ਹਿਰ ਦੇ ਵਿੱਚ ਡਾਕਟਰ ਸੁਰਜੀਤ ਹੈਗੇ ਆ ਹੱਡੀਆਂ ਦੇ ਮਾਹਰ ਹੈ ਜਿਨ੍ਹਾਂ ਦੇ ਕੋਲ ਬਹੁਤ ਬਾਹਰ ਦੇ ਸ਼ਹਿਰਾਂ ਦੇ ਵੀ ਲੋਕ ਆ ਕੇ ਇਲਾਜ ਕਰਾਉਂਦੇ ਆ ਡਾਕਟਰ ਪੰਨੂ ਹੈ ਉਹਨਾਂ ਦੇ ਅੱਖਾਂ ਦਾ ਸਪੈਸ਼ਲ ਹੌਸਪੀਟਲ ਹੈਗਾ ਉਨ੍ਹਾਂ ਦਾ ਅਤੇ ਗਾਇਨੀ ਦਾ ਹੋਸਪੀਟਲ ਹੈ ਉਨ੍ਹਾਂ ਦਾ ਔਰ ਡਾਕਟਰ ਬਜਿੰਦਰਾ ਹੈ ਚੌਵੀ ਘੰਟੇ ਚੌਵੀ ਐਮਰਜੈਂਸੀ ਸੇਵਾਵਾਂ ਉਨ੍ਹਾਂ ਕੋਲ ਚਲਦੀਆਂ ਡਾਕਟਰ ਪਰਮਾਰ ਜੀ ਹੈਗੇ ਹੈ ਅਤੇ ਡਾਕਟਰ ਸੁਧਰਨਾ ਜੀ ਚਾਈਲਡ ਸਪੈਸ਼ਲਿਸਟ ਖਾਸ ਤੌਰ 'ਤੇ ਮਤਲਬ ਕਿ ਕਾਫੀ ਦੂਰ ਦੂਰ ਤੋਂ ਨਾਲਾਗੜ੍ਹ ਤੱਕ ਸੁਰਾਊਡਿੰਗ ਏਰੀਏ ਤੋਂ ਲੋਕ ਉਹਨਾਂ ਕੋਲ ਆਉਂਦੇ ਆ ਔਰ ਜੇ ਆਪਾਂ ਗੱਲ ਕਰੀਏ ਕੋਵਿਡ ਦੇ ਟਾਈਮ 'ਤੇ ਤਾਂ ਮੇਰੇ ਆਪਣੇ ਖੁਦ ਦੇ ਨਾਲ ਜੋ ਬੀਤਿਆ ਹੋਇਆ ਹੈ ਮੇਰਾ ਆਪਣਾ ਪਰਸਨਲ ਇਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਹੰਢਿਆ ਹੋਇਆ ਹਿਸਾਬ ਕਿਤਾਬ ਕਹੂੰਗਾ ਮੈਂ ਅਤੇ ਬਹੁਤ ਵਧੀਆ ਤਰੀਕੇ ਦੇ ਨਾਲ ਹੋਸਪੀਟਲ ਨੇ ਲੋਕਾਂ ਨੂੰ ਸੰਭਾਲਿਆ ਹਰ ਰੋਜ਼ ਘੱਟੋ ਘੱਟ ਦੋ ਤੋਂ ਤਿੰਨ ਫੋਨ ਉਹਨਾਂ ਦੇ ਹੌਸਪੀਟਲ ਤੋਂ ਆਉਂਦੇ ਤੇ ਡੀ ਸੀ ਔਫਿਸ ਤੋਂ ਅਲੱਗ ਆਉਂਦਾ ਤਾ ਐੱਸ ਡੀ ਐਮ ਔਫਿਸ ਤੋਂ ਅਲੱਗ ਆਉਂਦਾ ਤਾ ਕਮੇਟੀ ਤੋਂ ਵੇਰਵਾ ਲਿੱਤਾ ਜਾਂਦਾ ਤਾ ਵਾਰ ਵਾਰ ਕਿਵੇਂ ਆ ਮਰੀਜ਼ ਦੀ ਸਿਹਤ ਸੰਭਾਲ ਹਾਲ ਹਾਲਤ ਸਾਰਾ ਕੁਛ ਤਾਂ ਕਦੇ ਕੋਈ ਕਿਸੇ ਕਿਸਮ ਦੀ ਕਮੀ ਨਹੀਂ ਮਹਿਸੂਸ ਹੋਈ ਕੋਵਿਡ ਦੇ ਟਾਈਮ 'ਤੇ ਵੀ ਬਹੁਤ ਵਧੀਆ ਤਰੀਕੇ ਨਾਲ ਸੰਭਾਲਿਆ